ਪੰਜਾਬੀ ਲੋਕ ਗੀਤ ਸਾਡੇ ਸੱਭਿਆਚਾਰਕ ਧਰੋਹਰ ਹਨ ਪੰਜਾਬ ਵਿੱਚ ਲੋਕ ਗੀਤਾਂ ਦਾ ਬਹੁਤ ਮਹੱਤਵ ਹੈ ਪੰਜਾਬ ਵਿੱਚ ਹਰੇਕ ਖੁਸ਼ੀ ਅਤੇ ਗਮ ਦੇ ਮੌਕਿਆਂ ਵਿੱਚ ਲੋਕ ਗੀਤਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਵੇਂ ਕਿ ਮਾਏ ਨੀ ਮਾਏ ਮੇਰੇ ਗੀਤਾਂ ਦੀ ਨਾਏ ਇਹ ਗੀਤ ਪੰਜਾਬ ਦੀ ਇਹ ਗਾਇਕ ਅਤੇ ਲੋਕ ਸੰਗੀਤ ਦੀ ਮਹਿਮਾ ਕਰਦਾ ਹੈ ਇਸ ਵਿੱਚ ਗਾਇਕ ਆਪਣੇ ਗੀਤਾਂ ਦੀ ਸ਼ਾਨ ਬਾਰੇ ਬਿਆਨ ਕਰਦਾ ਹੈ ਜਿਵੇਂ ਸੁੰਦਰ ਮੁੰਦਰੀਏ ਇਹ ਗੀਤ ਲੋਹੜੀ ਦੇ ਤਿਉਹਾਰਾਂ ਨਾਲ ਜੁੜਿਆ ਹੋਇਆ ਹੈ ਇਸ ਗੀਤ ਨੂੰ ਲੋਹੜੀ ਵਾਲੇ ਦਿਨ ਬੱਚੇ ਬੁੱਢੇ ਅਤੇ ਸਾਰੇ ਨੌਜਵਾਨ ਗਾਉਂਦੇ ਹਨ ਇਹ ਗੀਤ ਦੁੱਲਾ ਭੱਟੀ ਦੀ ਕਹਾਣੀ ਨੂੰ ਦਰਸਾਉਂਦਾ ਹੈ ਕਿ ਉਸਨੇ ਕਿਵੇਂ ਅਨਾਥ ਕੁੜੀ ਨੂੰ ਗੋਦ ਲੈ ਕੇ ਉਸ ਦਾ ਵਿਆਹ ਕਰਵਾਇਆ ਸੀ ਇਸ ਗੀਤ ਨੂੰ ਲੋਹੜੀ ਵਾਲੇ ਦਿਨ ਹਰੇਕ ਘਰ ਘਰ ਵਿੱਚ ਗਾਇਆ ਜਾਂਦਾ ਹੈ ਅਤੇ ਲੋਹੜੀ ਮੰਗੀ ਜਾਂਦੀ ਹੈ ਲੱਠੇ ਦੀ ਚਾਦਰ ਲੱਠੇ ਦੀ ਚਾਦਰ ਗੀਤ ਪੰਜਾਬੀ ਜੋਸ਼ ਮੌਜ ਮਸਤੀ ਨੂੰ ਦਰਸਾਉਂਦਾ ਹੈ ਇਸ ਗੀਤ ਨੂੰ ਭੰਗੜੇ ਵਿੱਚ ਵੀ ਬਹੁਤ ਪ੍ਰਯੋਗ ਕੀਤਾ ਜਾਂਦਾ ਹੈ ਇਹ ਗੀਤ ਪੰਜਾਬੀ ਲੋਕ ਜੀਵਨ ਸੁੰਦਰਤਾ ਨੂੰ ਦਰਸਾਉਂਦਾ ਹੈ ਮਾਏ ਨੀ ਮਾਏ ਮੈਂ ਕਿਹਨੂੰ ਆਖਾਂ ਇਹ ਗੀਤ ਵੀ ਦੁੱਖ ਅਤੇ ਵਿਛੋੜੇ ਨੂੰ ਦਿਖਾਉਂਦਾ ਹੈ ਇਸ ਗੀਤ ਵਿੱਚ ਪ੍ਰੇਮਿਕਾ ਦੇ ਹਿਰਦੇ ਦੀ ਤਰ ਤਕਲੀਫ ਨੂੰ ਦਰਸਾਇਆ ਹੈ ਇਹ ਇੱਕ ਦੁੱਖ ਭਰਿਆ ਹੋਇਆ ਗੀਤ ਹੈ ਬਾਬੁਲ ਮੇਰੇ ਇਸ ਗੀਤ ਨੂੰ ਵੀ ਵਿਆਹ ਦੇ ਸਮੇਂ ਵਿੱਚ ਗਾਇਆ ਜਾਂਦਾ ਹੈ ਇਹ ਗੀਤ ਬਹੁਤ ਹੀ ਮਸ਼ਹੂਰ ਹੈ ਹਰੇਕ ਵਿਆਹ ਸ਼ਾਦੀ ਵਿੱਚ ਇਸ ਗਾਣੇ ਦਾ ਪ੍ਰਯੋਗ ਜ਼ਰੂਰ ਕੀਤਾ ਜਾਂਦਾ ਹੈ